ਸਤਿ ਸ਼੍ਰੀ ਅਕਾਲ ਜੀ ਕੋਵਿਡ ਨਾਈਨਟੀਨ ਮਹਾਂਮਾਰੀ ਦੇ ਸੰਦਰਭ ਵਿੱਚ ਪੰਜਾਬ ਵਿੱਚ ਸਿੱਖਿਆ ਖੇਤਰ ਦੇ ਸਾਹਮਣੇ ਮੌਜੂਦਾ ਚੁਣੌਤੀਆਂ ਅਤੇ ਬਹੁਤ ਸਾਰੇ ਮੌਕੇ ਆਏ ਸਨ ਜਿਵੇਂ ਕਿ ਇਸ ਦੇ ਸਮੇਂ ਸਕੂਲ ਬੰਦ ਹੋ ਗਏ ਸੀ ਅਤੇ ਸਕੂਲ ਬੰਦ ਹੋਣ ਕਾਰਨ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਬਹੁਤ ਹੀ ਜ਼ਿਆਦਾ ਮੁਸ਼ਕ ਮੁਸ਼ਕਲਾਂ ਦੇਖਣੀਆਂ ਪੈ ਗਈਆਂ ਸਨ ਇਸ ਵਿੱਚ ਜਿਵੇਂ ਕਿ ਪਹਿਲਾਂ ਪੜ੍ਹਾਈ ਔਫਲਾਈਨ ਹੁੰਦੀ ਸੀ ਬਟ ਕੋਵਿਡ ਨਾਈਟੀਨ ਦੇ ਵਿੱਚ ਪੜ੍ਹਾਈ ਆਨਲਾਈਨ ਹੋਣ ਲੱਗ ਪਈ ਜਿਸ ਦੇ ਕਾਰਨ ਬੱਚੇ ਬਹੁਤ ਹੀ ਜ਼ਿਆਦਾ ਫੋਨ ਦੇ ਆਦੀ ਹੋ ਗਏ ਸਨ ਅਤੇ ਫੋਨ ਨੂੰ ਛੱਡਦੇ ਹੀ ਨਹੀਂ ਸਨ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੇ ਬਹੁਤ ਹੀ ਗਲਤ ਚੀਜ਼ਾਂ ਵੀ ਫੋਨ ਤੋਂ ਸਿੱਖਣੀਆਂ ਸ਼ੁਰੂ ਕਰ ਦਿੱਤੀਆਂ ਜਿਹਦਾ ਕਿ ਬਹੁਤ ਗਲਤ ਅਸਰ ਬੱਚਿਆਂ 'ਤੇ ਅਤੇ ਉਸ ਦੇ ਪਰਿਵਾਰਾਂ 'ਤੇ ਪੈਣ ਲੱਗ ਪਿਆ ਹੋਰ ਵੀ ਬਹੁਤ ਸਾਰੀਆਂ ਚੁਨੌਤੀਆਂ ਪੰਜਾਬ ਦੇ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਸੀ ਜਿਵੇਂ ਕਿ ਕੋਵਿਡ ਨਾਈਟੀਨ ਦੇ ਕਾਰਨ ਪੰਜਾਬ ਬੰਦ ਹੋ ਗਿਆ ਸੀ ਅਤੇ ਕਿਸੇ ਨੂੰ ਵੀ ਬਾਹਰ ਜਾਣ ਦੀ ਕੋਈ ਵੀ ਅਸ ਸਜ਼ਾ ਨਹੀਂ ਸੀ ਦਿੱਤੀ ਗਈ ਬਾਹਰ ਜਾਣਾ ਸਖ਼ਤ ਮਨਾ ਕਰ ਦਿੱਤਾ ਗਿਆ ਸੀ ਅਤੇ ਜਿਹੜਾ ਵੀ ਬਾਹਰ ਜਾਂਦਾ ਸੀ ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੰਦੇ ਸੀ ਬਾਹਰ ਨਾ ਜਾਣ ਦੇ ਕਾਰਨ ਬਹੁਤ ਸਾਰੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਸੀ ਜਿਹਨਾਂ ਦੇ ਕਾਰਨ ਉਨ੍ਹਾਂ ਦੀ ਕਮਾਈ 'ਤੇ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਕਮਾਈ ਨਾ ਆਉਣ ਕਰਕੇ ਘਰ ਦੇ ਵਿੱਚ ਕੁਛ ਖਾਣ ਨੂੰ ਵੀ ਨਹੀਂ ਸੀ ਬਚਦਾ ਜਿਹਦੇ ਕਾਰਨ ਉਨ੍ਹਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਕੋਵਿਡ ਨਾਈਟੀਨ ਦੇ ਕਾਰਨ ਕਈ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਫਰਕ ਆਇਆ ਹੈ ਅਤੇ ਉਨ੍ਹਾਂ ਨੂੰ ਬਹੁਤ ਸਾਰੀਆਂ ਚੁਨ ਚੁਨੌਤੀਆਂ ਦਾ ਹਜੇ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਧੰਨਵਾਦ ਜੀ